ਜੀ ਹਾਂ ਪੰ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਮੇਰੇ ਲਈ ਬਾਈਕਿੰਗ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪੈਟਰੋਲ ਦੀ ਕੀਮਤ ਜਿਹੜੀ ਹੈ ਛਿਆਨਵੇਂ ਰੁਪਏ ਕੁਛ ਹੈਗੀ ਹੈ ਜਿਹੜੀ ਕਿ ਸੌ ਰੁਪਏ ਪ੍ਰਤੀ ਲੀਟਰ ਪੈਟਰੋਲ ਜਿਹੜਾ ਹੈ ਉਹ ਪੈਟਰੋਲ ਪੰਪਾਂ 'ਤੇ ਵੇਚਿਆ ਜਾ ਰਿਹਾ ਹੈ ਜਿਹਦੇ ਕਰਕੇ ਕਿ ਬਾਈਕਿੰਗ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਮੇਰੇ ਲਈ ਜਿੱਥੇ ਮੈਂ ਆਪਣੀ ਸਕੂਟਰੀ 'ਤੇ ਜਾਣਾ ਹੁੰਦਾ ਸੀ ਹਰ ਜਗ੍ਹਾ 'ਤੇ ਬਾਜ਼ਾਰ ਜਾਣਾ ਹੁੰਦਾ ਸੀ ਤਾਂ ਹੁਣ ਉੱਥੇ ਜਾਣ ਵਾਸਤੇ ਸੋਚਣਾ ਪੈਂਦਾ ਹੈ ਕਿ ਇਹ ਸੌ ਰੁਪਏ ਪ੍ਰਤੀ ਲੀਟਰ ਪੈਟਰੋਲ ਭਰਵਾਉਣਾ ਪਵੇਗਾ ਅਤੇ ਫਿਰ ਬਾਜ਼ਾਰ ਦੇ ਵਿੱਚ ਜਾ ਜਾਣਾ ਪਵੇਗਾ ਇਸ ਤੋਂ ਚੰਗਾ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਬਾਜ਼ਾਰ ਜਾਈਏ ਹੀ ਨਾ ਜਾਂ ਇਕੱਠਾ ਇ ਇੱਕੋ ਵਾਰ 'ਚ ਲ ਸਮਾਨ ਲੈ ਕੇ ਆਈਏ ਜੋ ਵੀ ਲੈ ਕੇ ਆਉਣਾ ਹੈ ਨਹੀਂ ਤਾਂ ਅੱਗੇ ਅਗਰ ਪੈਟਰੋਲ ਸਸਤਾ ਹੋਵੇ ਤਾਂ ਅਸੀਂ ਆਪਣੀ ਰੋਜ਼ ਦੀਆਂ ਜ਼ਰੂਰਤਾਂ ਨੂੰ ਬਾਜ਼ਾਰ ਜਾ ਕੇ ਪੂਰਾ ਕਰ ਸਕਦੇ ਹਾਂ ਦੂਸਰਾ ਇਹਦਾ ਦੁਸ਼ਪ੍ਰਭਾਵ ਇਹ ਪਿਆ ਹੈ ਕਿ ਇਹਦੇ ਨਾਲ ਪੋਲਿਊਸ਼ਨ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਰਿਹਾ ਹੈ ਜਿਹਦੇ ਕਰਕੇ ਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਪੋਲਿਊਸ਼ਨ ਪ੍ਰਦੂਸ਼ਣ ਕਰਕੇ ਕਿ ਜਿਹੜੀ ਕਿ ਲੋ ਜਿਹਦੇ ਨਾਲ ਲੋਕਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਬਾਹਰ ਜਾਣਾ ਵੀ ਬਹੁਤ ਔਖਾ ਹੈ ਮੈਨੂੰ ਲੱਗਦਾ ਹੈ ਕਿ ਇਹ ਪੈਟਰੋਲ ਦੀ ਜ਼ਿਆਦਾ ਵਰਤੋਂ ਦੇ ਨਾਲ ਵਾਤਾਵਰਨ ਦੇ ਵਿੱਚ ਜਿਹੜੀ ਪ੍ਰਦੂਸ਼ਣ ਦੀ ਮਾਤਰਾ ਹੈ ਉਹ ਅੱਗੇ ਨਾਲੋਂ ਬਹੁਤ ਹੀ ਜ਼ਿਆਦਾ ਵਧ ਚੁੱਕੀ ਹੈ ਬਹੁਤ ਜ਼ਿਆਦਾ ਵੱਡੇ ਸਤਰ 'ਤੇ ਵਧ ਚੁੱਕੀ ਹੈ ਔਰ ਪਹਿਲਾਂ ਦੀ ਬਜਾਏ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਵਾਰ ਹਰ ਸਾਲ ਜਿਹੜੀ ਗਰਮੀ ਪੈਂਦੀ ਹੈ ਉਹ ਵੱਧਦੀ ਜਾ ਰਹੀ ਹੈ ਪਿਛਲੇ ਸਾਲ ਦੇ ਨਾਲੋਂ